ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਕਿੰਨੀਆਂ ਹੀ ਟਕਨੋਲਜੀਆਂ ਅੱਗੇ ਤੋਂ ਅੱਗੇ ਵੱਧ ਰਹੀਆਂ ਹਨ ਉਹਨਾਂ ਦੇਸ਼ਾਂ ਦੇ ਮੁਕਾਬਲੇ ਸਾਡਾ ਇੰਡੀਆ ਵੀ ਘੱਟ ਨਹੀਂ ਹੈਗਾ ਅਤੇ ਜਦੋਂ ਦਾ ਮੋਦੀ ਮੋਦੀ ਸਰਕਾਰ ਆਈ ਹੈਗੀ ਆ ਉਦੋਂ ਦਾ ਤਾਂ ਕਾਫ਼ੀ ਟਕਨੋਲਜੀਆਂ 'ਚ ਵਾਧਾ ਹੋਇਆ ਜਿਵੇਂ ਕਿ ਡਰੋਨ ਵੈਗਰਾ ਸੈਟਾਲਾਈਟ ਹੋਰ ਕਾਫ਼ੀ ਜ਼ਿਆਦਾ ਟਕਨੋਲਜੀਆਂ ਆਪਣੇ ਭਾਰਤ ਦੇ ਵਿੱਚ ਹੋ ਗਈਆਂ ਹਨ ਜਿੱਥੋਂ ਤੱਕ ਦੇਖਿਆ ਜਾਵੇ ਸਾਡਾ ਇੰਡੀਆ ਭਾਰਤ ਮਤਲਬ ਪਾਕਿਸਤਾਨ ਤੋਂ ਕਾਫ਼ੀ ਜ਼ਿਆਦਾ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਕਾਫ਼ੀ ਜ਼ਿਆਦਾ ਉੱਤੇ ਚਲਾ ਗਿਆ ਆ ਜਿਵੇਂ ਪਿੱਛੇ ਕੁ ਨੂੰ ਚੰਦਰਯਾਨ ਚੰਦਰਮਾ 'ਤੇ ਭੇਜਿਆ ਸੀਗਾ ਉਹ ਉਹਦੇ ਉਹਦੇ ਕਰਕੇ ਬਹੁਤ ਜ਼ਿਆਦਾ ਇੰਡੀਆ ਦਾ ਨਾਮ ਹੋਇਆ ਸੀਗਾ ਪਾਕਿਸਤਾਨ ਵਾਲਿਆਂ ਦਾ ਤਾਂ ਦੇਖ ਕੇ ਸੁਣ ਕੇ ਵੀ ਕਹਿੰਦੇ ਸੀਗੇ ਵੀ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਕਿ ਅਸੀਂ ਇੱਦਾਂ ਦਾ ਕਦੇ ਕਰ ਸਕਦੇ ਹਾਂ ਇੰਡੀਆਂ ਵਾਲਿਆਂ ਨੇ ਤਾਂ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਆਪਣਾ ਨਾਮ ਰੋਸ਼ਨ ਕੀਤਾ ਵੈਸੇ ਤਾਂ ਚਲੋ ਸਾਰੇ ਹੀ ਦੇਸ਼ ਤਰੱਕੀਆਂ ਕਰਦੇ ਆ ਕਰਦੇ ਰਹਿਣ ਪਰ ਸਾਡਾ ਭਾਰਤ ਸਾਡਾ ਭਾਰਤ ਹੀ ਹੈ